ਹਾਂਜੀ ਪਰਮਜੀਤ ਜੀ ਬੋਲ ਰਹੇ ਹਾਂਜੀ ਹਾਂਜੀ ਹਾਂਜੀ ਹਾਂਜੀ ਸੁਬਹ ਕਾ ਨਾਸ਼ਤਾ ਸਵੇਰ ਦਾ ਨਾਸ਼ਤਾ ਥੋੜ੍ਹੇ ਜਿਹੇ ਸਪਰਾਊਟ ਕਰ ਲਿਓ ਔਰ ਇੱਕ ਸ਼ੇਕ ਕਰ ਲਿਓ ਔਰ ਸੈਂਡਵਿਚ ਕਰ ਲਿਓ ਕੋਈ ਵੀ ਬਣਾ ਲਿਓ ਕੋਈ ਵੀ ਹਾਂਜੀ ਕੋਈ ਵੀ ਬਣਾ ਲਿਓ ਹਲਕਾ ਜਿਹਾ ਹੋਵੇ ਹਾਂਜੀ ਅਤੇ ਆਪਣਾ ਸੈਂਡਵਿਚ ਵੀ ਕਰ ਲਿਓ ਹਾਂਜੀ ਔਰ ਲੰਚ ਦੇ ਵਿੱਚ ਚਾਵਲ ਚਾਵਲ ਬਣਾ ਲਿਓ ਇੱਕ ਦਾਲ ਦਾਲ ਬਣਾ ਲਿਓ ਇੱਕ ਸੁੱਕੀ ਸਬਜ਼ੀ ਹਾਂਜੀ ਥੋੜ੍ਹੇ ਜਿਹੇ ਮਟਰ ਪਾ ਲਿਓ ਉਹਦੇ 'ਚ ਹਾਂ ਹਾਂਜੀ ਠੀਕ ਹੈ ਇੱਕ ਦਾਲ ਬਣਾ ਲਿਓ ਅਤੇ ਇੱਕ ਸੁੱਕੀ ਸਬਜ਼ੀ ਬਣਾ ਲਿਓ

ਹਾਂਜੀ ਔਰ ਦਹੀਂ ਦਾ ਰਾਇਤਾ ਪਾ ਲਿਓ ਔਰ ਮਿੱਠੇ ਦੇ ਵਿੱਚ ਮੂੰਗੀ ਦਾ ਕੜਾਹ ਬਣਾ ਲਿਓ ਠੀਕ ਹੈ ਔਰ ਸ਼ਾਮ ਸ਼ਾਮ ਨੂੰ ਚਾਰ ਵਜੇ ਚਾਹ ਅਤੇ ਚਾਹ ਦੇ ਨਾਲ ਪਕੌੜੇ ਸਨੈਕਸ ਹੋ ਜਾਣ ਥੋੜ੍ਹੇ ਜਿਹੇ ਹਾਂਜੀ ਕੋਈ ਹਲਕਾ ਫੁਲਕਾ ਨਾਸ਼ਤਾ ਔਰ ਹਾਂਜੀ ਅਸੀਂ ਹੈਗੇ ਚਾਰ ਪੰਜ ਜਣੇ ਹੈਗੇ ਅਸੀਂ ਹਾਂਜੀ ਔਰ ਇੱਕ ਨਾਈ ਨਾਈਟ ਦੇ ਡਿੰਨਰ ਵਾਸਤੇ ਔਰ ਮਨਚੂਰੀਅਨ ਔਰ ਕੋਫਤੇ ਬਣਾ ਲਿਓ ਹੂੰ ਔਰ ਫੁਲਕੇ ਬਣਾ ਲਿਓ ਥੋੜ੍ਹੇ ਜਿਹੇ ਰਾਈਸ ਬਣਾ ਲਿਓ ਹਾਂਜੀ ਔਰ ਹਾਂਜੀ ਮਿੱਠੇ ਦੇ ਵਿੱਚ ਬਣਾ ਲਿਓ ਖੀਰ ਔਰ ਹਾਂਜੀ ਰਾਇਤਾ ਵੀ ਰੱਖ ਲੀਓ ਇੱਕ ਗਾਜਰ ਦਾ ਹਲਵਾ ਰੱਖ ਲੀ ਹਾਂਜੀ ਗਾਜਰ ਦਾ ਹਲਵਾ ਰੱਖ ਲੀਓ ਹਾਂਜੀ ਔਰ ਹਾਂਜੀ ਹਾਂਜੀ ਅਤੇ ਸਵੇ ਸਵੇਰੇ ਰਾ ਕਰ ਦਿਓ ਤੁਸੀਂ ਦਸ ਕਰ ਵਜੇ ਤੱਕ ਓਡਰ ਹਾਂਜੀ ਔਰ ਦੁਪਹਿਰ ਨੂੰ ਦੋ ਢਾਈ ਵਜੇ ਹਾਂਜੀ ਸ਼ਾਮ ਦੀ ਚਾਰ ਚਾਹ ਜਿਹੜੀ ਆ ਸ਼ਾਮ ਨੂੰ ਮਤਲਬ ਕਿ ਚਾਰ ਵਜੇ ਔਰ ਰਾਤ ਦੀ ਰੋਟੀ ਨੌਂ ਕੁ ਵਜੇ ਤੱਕ ਕਰ ਲਿਓ

ਹਾਂਜੀ ਹਾਂਜੀ ਹੈਲਪਰ ਭੇਜ ਦਾਂਗੇ ਹਾਂਜੀ ਇੱਕ ਕੁੜੀ ਹੈਗੀ ਸਾਡੇ ਕੋਲ ਅਸੀਂ ਭੇਜ ਦਾਂਗੇ ਠੀਕ ਹੈ ਜੀ ਧੰਨਵਾਦ